ਸਾਡੇ ਦੇਸ਼ ਵਿੱਚ ਕਈ ਸੱਭਿਆਚਾਰ ਤਿਉਹਾਰ ਮਨਾਏ ਜਾਂਦੇ ਹਨ ਰੱਖੜੀ ਹੋਲੀ ਦੁਸਹਿਰਾ ਦੀਵਾਲੀ ਜੇਕਰ ਤੁਸੀਂ ਦੀਵਾਲੀ ਦੀ ਗੱਲ ਕਰਦੇ ਹਨ ਤਾਂ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਲੋਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ ਦੀਵਾਲੀ ਤੋਂ ਤਿਉਹਾਰ ਤੋਂ ਕੁਛ ਦਿਨ ਪਹਿਲਾਂ ਹੀ ਸਾਰੇ ਲੋਕ ਆਪਣੇ ਘਰ ਦੀ ਸਫ਼ਾਈਆਂ ਕਰਨ ਲੱਗ ਜਾਂਦੇ ਹਨ ਇਸ ਦਿਨ ਦਾ ਲੋਕਾਂ ਨੂੰ ਬਹੁਤ ਚਾਅ ਹੁੰਦਾ ਹੈ ਅਤੇ ਕਈ ਲੋਕ ਆਪਣੇ ਘਰਾਂ ਨੂੰ ਰੰਗ ਵੀ ਕਰਵਾਉਂਦੇ ਹਨ ਦੀਵਾਲੀ ਦੇ ਤਿਉਹਾਰ ਵਾਲੇ ਦਿਨ ਲੋਕ ਆਪਣੇ ਘਰਾਂ 'ਚ ਸ਼ਾਮ ਨੂੰ ਮਿਠਾਈਆਂ ਦੇ ਡੱਬੇ ਲੈ ਕੇ ਜਾਂਦੇ ਹਨ ਅਤੇ ਜਿਹੜੇ ਬੱਚੇ ਆ ਉਹ ਆਪਣੇ ਵਾਸਤੇ ਪਟਾਕੇ ਵੀ ਲੈ ਕੇ ਆਉਂਦੇ ਹਨ ਹਿ ਹਿੰਦੂ ਧਰਮ ਇਸ ਦਿਨ ਸ਼ਾਮ ਨੂੰ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ ਕਿਉਂਕਿ ਇਸ ਦਿਨ ਸ਼ ਸ਼੍ਰੀ ਰਾਮ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਆਪਣੇ ਘਰ ਵਾਪਸ ਆਉਂਦੇ ਹਨ ਇਸ ਖੁਸ਼ੀ ਵਿੱਚ ਲੋਕ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ